ਪੰਜ ਫਰਵਰੀ ਦੋ ਹਜ਼ਾਰ ਛੇ ਤੇਰਾਂ ਦਿਸੰਬਰ ਦੋ ਹਜ਼ਾਰ ਅੱਠ ਚੌਦਾਂ ਜੁਲਾਈ ਦੋ ਹਜ਼ਾਰ ਚੌਦਾਂ ਬਾਰਾਂ ਫਰਵਰੀ ਉੱਨੀ ਸੌ ਤਰੱਨਵੇ ਚੌਵੀ ਅਗਸਤ ਉੱਨੀ ਸੌ ਸੰਨਤਾਲੀ